ਸਤਿ ਸ਼੍ਰੀ ਅਕਾਲ ਜੀ ਹਾਂਜੀ ਜੀ ਤੁਹਾਡਾ ਨੰਬਰ ਨਾ ਮੈਨੂੰ ਕਿਰਨ ਤੋਂ ਮਿਲਿਆ ਸੀ ਜੀ ਹਾਂਜੀ ਹਾਂਜੀ ਅਸੀਂ ਨਾ ਤੁਹਾਡੇ ਗਵਾਂਢ ਨਵੇਂ ਆਏ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਅਸੀਂ ਆਏ ਆਂ ਅਤੇ ਅਸੀਂ ਮੈਂ ਪੁੱਛਣਾ ਸੀ ਦੀਦੀ ਇਥੇ ਨਾ ਦੁੱਧ ਕਿੱਥੋਂ ਮਿਲਦਾ ਜਿੱਦਾਂ ਡੇਅਰੀ ਵਗੈਰਾ ਕੋਈ ਹੈਗੀ ਲਾਗੇ

ਅੱਛਾ ਜੀ ਜੀ ਮੱਝ ਦਾ ਅੱਛਾ ਜੀ ਜੇ ਤੁਹਾਨੂੰ ਪਤਾ ਤੁਹਾਨੂੰ ਤੁਹਾਨੂੰ ਪਤਾ ਹੀ ਹੋਊਗਾ ਕਿ ਕਿੱਥੋਂ ਮਿਲਦਾ ਵਧੀਆ ਕਿਥੋਂ ਨਹੀਂ ਦਹੀਂ ਲੱਸੀ ਵਗੈਰਾ ਵੀ ਮਿਲ ਜਾਂਦਾ ਉਥੋਂ ਅੱਛਾ ਜੀ ਠੀਕ ਹੈ ਜੀ ਅਸੀਂ ਨਾ ਹੁਣ ਅੱਜ ਤਾਂ ਚਲੋ ਕੋਈ ਨੀ ਸਾਡਾ ਸਰ ਗਿਆ ਅਸੀਂ ਕੱਲ੍ਹ ਨੂੰ ਹੁਣ ਜਾਣਾ ਏ ਤਾਂ ਤੁਸੀਂ ਕੱਲ੍ਹ ਨੂੰ ਸਾਡੇ ਨਾਲ਼ ਚੱਲੋਗੇ ਨਹੀਂ ਜੀ ਨਹੀਂ ਹੁਣ ਤਾਂ ਕੋਈ ਨੀ ਹੁਣ ਤਾਂ ਸਾਡਾ ਸਰ ਗਿਆ ਏ ਨਾ ਅਸੀਂ ਜਿੱਥੋਂ ਦੁੱਧ ਲੈਂਦੇ ਸੀ ਨਾ ਉਹਨਾਂ ਦਾ ਰੇਟ ਬਹੁਤ ਹਾਈ ਸੀ ਇਹ ਇਹਨਾ ਇਨਾ ਹਾਂਜੀ ਇਹਨਾਂ ਦਾ ਰੇਟ ਕਿੱਦਾਂ ਠੀਕ ਠੀਕ ਹੈ ਜੀ ਅੱਛਾ ਜੀ ਅਤੇ ਦਹੀਂ ਲੱਸੀ ਦਹੀਂ ਲੱਸੀ ਦਾ ਪ੍ਰਾਈਜ਼ ਠੀਕ ਹੈ ਜੀ ਠੀਕ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਦੀਦੀ ਕੱਲ੍ਹ ਨੂੰ ਤੁਸੀਂ ਤੁਸੀਂ ਹਾਂਜੀ ਠੀਕ ਹੈ ਜੀ ਐਨੀ ਕੁ ਹੈਲਪ ਕਰ ਦਿਓ ਤੁਸੀਂ ਮੇਰੀ ਜੀ ਓ ਓਕੇ ਜੀ ਓਕੇ